ਸਾਡੇ ਪਿੰਡਾਂ ਵਿੱਚ ਜਿਵੇਂ ਕਿ ਨੌਜਵਾਨ ਹੁੰਦੇ ਹਨ ਜਿੱਦਾਂ ਕਿ ਕਿਸੇ ਦਾ ਦੋਸਤ ਮਿੱਤਰ ਜਾਂ ਅਸੀਂ ਇਕੱਠੇ ਪੜ੍ਹਦੇ ਹਨ ਸਾਡੇ ਸਕੂਲਾਂ ਵਿੱਚ ਪ੍ਰੋਗਰਾਮ ਹੁੰਦੇ ਹਨ ਅਸੀਂ ਉਹ ਇੱਕ ਦੂਸਰੇ ਨੂੰ ਦੱਸ ਦਿੰਦੇ ਹਾਂ ਅਤੇ ਫਿਰ ਇਸ ਤਰ੍ਹਾਂ ਸਾਡੇ ਡਾਂਸ ਕਲਾਸਾਂ ਵਿੱਚ ਜਾਂਦੇ ਹਨ ਅਤੇ ਵੱਖ ਵੱਖ ਲੋਕ ਜਿਹੜੇ ਹੁੰਦੇ ਹਨ ਵੱਖ ਵੱਖ ਤਰੀਕੇ ਨਾਲ ਡਾਂਸ ਸਿਖਾਉਂਦੇ ਹਨ ਫਿਰ ਇਸ ਤਰ੍ਹਾਂ ਸਾਡੇ ਗਰੁੱਪ ਬਣਾਏ ਜਾਂਦੇ ਹਨ ਜਿਸ ਤਰ੍ਹਾਂ ਇੱਕ ਦੂਸਰੇ ਦਾ ਦੋਸਤ ਇੱਕ ਦੂਸਰੇ ਦੇ ਦੋਸਤ ਨੂੰ ਦੱਸਦੇ ਹਾਂ ਕਿ ਇਸ ਤਰ੍ਹਾਂ ਉੱਥੇ ਵਧੀਆ ਮਸਟਰ ਆ ਡਾਂਸ ਸਿਖਾਉਣ ਵਾਲਾ ਉੱਥੇ ਵਧੀਆ ਟੀਚਰ ਆ ਡਾਂਸ ਸਿਖਾਉਣ ਵਾਲਾ ਇਸ ਤਰ੍ਹਾਂ ਸਾਨੂੰ ਇੱਕ ਦੂਜੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਇਸ ਤਰ੍ਹਾਂ ਅਸੀਂ ਆਪੋ ਆਪਣਾ ਡਾਂਸ ਸਿੱਖਣ ਵਾਸਤੇ ਇੱਕ ਦੂਸਰੇ ਨੂੰ ਕਰਦੇ ਹਾਂ ਕਿ ਇਸ ਤਰ੍ਹਾਂ ਸਿੱਖਣ ਵਾਸਤੇ ਇੱਕ ਦੂਜੇ ਨੂੰ ਉਤਾਸਿਸ ਆ ਗਲਤੀ